ਮੈਂ ਦੋ ਤਿੰਨ ਘੰਟੇ ਯੂਟਿਊਬ ਐਪ ਉੱਤੇ ਬਿਤਾਉਂਦਾ ਹਾਂ ਮੈਂ ਇਸ ਉੱਪਰ ਖਬਰਾਂ ਸੁਣਦਾ ਹਾਂ ਅਤੇ ਸਤਿਸੰਗ ਨੂੰ ਸੁਣਦਾ ਹਾਂ ਇਹ ਐਪ ਦਿਨ ਬ ਦਿਨ ਹੋ ਰਹੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ